ਘੁੰਮਣਾ ਘੁੰਮਣ ਦਾ ਮੌਸਮ ਸਭ ਤੋਂ ਵੱਧ ਵਧੀਆ ਆਪਣਾ ਮਾਰਚ ਅਪ੍ਰੈਲ ਹੈ ਇਸ ਮੌਸਮ ਵਿੱਚ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਠੰਡ ਹੁੰਦੀ ਹੈ ਮਾਰਚ ਅਪ੍ਰੈਲ ਤੋਂ ਇਲਾਵਾ ਸਪਤੰਬਰ ਅਕਤੂਬਰ ਵੀ ਮੌਸਮ ਕਾਫੀ ਵਧੀਆ ਮੰਨਿਆ ਜਾਂਦਾ ਹੈ ਇਸ ਟਾਈਮ ਵੀ ਮੌਸਮ ਠੰਡਾ ਰਹਿੰਦਾ ਹੈ ਗਰਮੀਆਂ ਦੇ ਵਿੱਚ ਘੁੰਮਣ ਜਾਣ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਗਰਮੀਆਂ ਜੇ ਘੁੰਮਣ ਜਾਣਾ ਬੰਦੇ ਨੇ ਫੇਰ ਪਹਾੜੀ ਇਲਾਕੇ ਦੇ ਵਿੱਚ ਘੁੰਮਣ ਲਈ ਜਾ ਸਕਦਾ ਪਹਾੜੀ ਇਲਾਕਿਆਂ ਦੇ ਵਿੱਚ ਕੁੱਲੂ ਮਨਾਲੀ ਹੋ ਮਕਲੋੜਗੰਜ ਸ਼ਿਮਲਾ ਧਰਮਸ਼ਾਲਾ ਜਾਂ ਡਲਹੌਜ਼ੀ ਇਹ ਜਗ੍ਹਾ ਕਾਫੀ ਠੰਡੀਆਂ ਹੁੰਦੀਆਂ ਹਨ ਨਾ ਜ਼ਿਆਦਾ ਠੰਡ ਹੁੰਦੀ ਹੈ ਨਾ ਜ਼ਿਆਦਾ ਗਰਮੀ ਹੁੰਦੀ ਹੈ ਇਸ ਜਗ੍ਹਾ 'ਤੇ ਜਾ ਕੇ ਬੰਦਾ ਆਪਣੀ ਫੈਮਿਲੀ ਦੇ ਨਾਲ ਕਾਫੀ ਇੰਜੋਏ ਕਰ ਲੈ ਸਕਦਾ ਹੈ ਜ਼ਿਆਦਾ ਜਨਵਰੀ ਜਾਂ ਦਸੰਬਰ ਜਾਣ ਦੇ ਵਿੱਚ ਬੰਦੇ ਨੂੰ ਘੁੰਮਣ ਘੁੰਮਾਉਣ ਦੀ ਜ਼ਿਆਦਾ ਦਿੱਕਤ ਆਉਂਦੀ ਹੈ ਜ਼ਿਆਦਾ ਧੁੰਦਾਂ ਪੈਂਦੀਆਂ ਹਨ ਠੰਡ ਜ਼ਿਆਦਾ ਹੁੰਦੀ ਹੈ ਅਤੇ ਜ਼ਿਆਦਾ ਕੱਪੜੇ ਵਗੈਰਾ ਨਾਲ ਲੈ ਕੇ ਜਾਣੇ ਪੈਂਦੇ ਹਨ ਸਭ ਤੋਂ ਵੱਧ ਵਧੀਆ ਮੌਸਮ ਅਪ੍ਰੈਲ ਮਾਰਚ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਜਾਂ ਗਰਮੀਆਂ ਦੇ ਵਿੱਚ ਆਪਣਾ ਸਪਤੰਬਰ ਅਕਤੂਬਰ ਮਹੀਨਾ ਸਭ ਤੋਂ ਵੱਧ ਵਧੀਆ ਮੰਨਿਆ ਜਾਂਦਾ ਹੈ